ਰੋਜ਼ਾਨਾ ਅਨੁਭਵ ਅਤੇ ਨਿਰੀਖਣ ਸਾਡੀ ਲਿਖਤ ਨੂੰ ਬਹੁਤ ਹੀ ਪ੍ਰਭਾਵਿਤ ਕਰਦਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਡੇ ਦਿਨ ਚਰਿਆਂ ਵਿੱਚ ਬਹੁਤ ਜਿਹੀ ਗੱਲਾਂ ਇਹੋ ਜਿਹੀਆਂ ਹੁੰਦੀਆਂ ਹਨ ਵੀ ਜਿਹੜੀ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਅਤੇ ਜੇ ਉਹ ਆਪਾਂ ਉਸ ਨੂੰ ਇੱਕ ਪੰਨੇ ਉੱਤੇ ਨਿਖਾਰ ਕੇ ਲਿਖ ਸਕਦੇ ਹਾਂ ਸਾਨੂੰ ਆਪਣੀਆਂ ਮਨ ਦੀਆਂ ਭਾਵਾਂਵਾਂ ਨੂੰ ਲਿਖਣ ਲਈ ਕੋਈ ਸ਼ੱਕ ਨਹੀਂ ਅਤੇ ਇਸ ਕਰਕੇ ਅਸੀਂ ਆਪਣੇ ਮਨ ਦੇ ਭਾਵਾਂ ਨੂੰ ਇੱਕ ਪੰਨੇ ਉੱਤੇ ਲਿਖ ਸਕਦੇ ਹਾਂ ਮੈਂ ਬਹੁਤ ਜੇ ਲੇਖਕ ਵੇਖੇ ਹਨ ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਲਿਖਤੀ ਰਚਨਾਵਾਂ ਵਿੱਚ ਗੁਜ਼ਾਰ ਤੀ ਉਹਨਾਂ ਦਾ ਮੰਨਣਾ ਇਹ ਸੀ ਵੀ ਅਸੀਂ ਆਪਣੇ ਮਨ ਦੇ ਭਾਵਾਵਾਂ ਨੂੰ ਦੂਜਿਆਂ ਅੱਗੇ ਪ੍ਰਗਟ ਕਰਨ ਨਾਲੋਂ ਚੰਗਾ ਹੈ ਕਿ ਅਸੀਂ ਆਪਣੇ ਇੱਕ ਕਾਪੀ ਵਿੱਚ ਉਹਨੂੰ ਵੰਡ ਲਈਏ ਜੇ ਆਪਾਂ ਲਿਖਤੀ ਰੂਪ ਨਾ ਦੇ ਕੇ ਜੇ ਆਪਾਂ ਕਿਸੇ ਨਾਲ ਗੱਲ ਕਰਾਂਗੇ ਤਾਂ ਕਈ ਲੋਕਾਂ ਨੂੰ ਇਸ ਬਾਰੇ ਬਿਲਕੁਲ ਵੀ ਚੰਗਾ ਨਹੀਂ ਲੱਗਦਾ ਕਿ ਉਹ ਆਪਣੀ ਮਨ ਦੀ ਗੱਲ ਕਿਸੇ ਅੱਗੇ ਖੋਲ੍ਹ ਕੇ ਉਸਨੂੰ ਸਾਂਝਾ ਕਰੀਏ ਤਾਂ ਹੀ ਲੋਕ ਰਚਨਾਵਾਂ ਨੂੰ ਪਹਿਲ ਦਿੰਦੇ ਹਨ ਇਹ ਵੀ ਬਹੁਤ ਘੱਟ ਕੁ ਲੋਕ ਹੁੰਦੇ ਹਨ ਜਿਹੜੇ ਕਿ ਲਿਖਣ ਵਿੱਚ ਵਿਸ਼ਵਾਸ ਕਰਦੇ ਹਨ ਜੀ ਮੇਰੀ ਇੱਕ ਜੀਵਨ ਦੀ ਘਟਨਾਵਾਂ ਦਾ ਉਦਾਹਰਣ ਹੈ ਮੈਂ ਆਪਣੇ ਪੇਪਰਾਂ ਵਿੱਚ ਘੱਟ ਨੰਬਰ ਆਉਣ ਕਾਰਨ ਮੈਂ ਇਸ ਟੈਨਸ਼ਨ ਜਾਂ ਪਰੇਸ਼ਾਨੀ ਨੂੰ ਕਿਸੇ ਨਾਲ ਵੰਡ ਨਹੀਂ ਪਾ ਰਹੀ ਸੀ ਅਤੇ ਮੈਂ ਉਸ ਨੂੰ ਆਪਣੀ ਇੱਕ ਡਾਇਰੀ ਦੇ ਮਾਧਿਅਮ ਨਾਲ ਲਿਖਣਾ ਸ਼ੁਰੂ ਕੀਤਾ ਅਤੇ ਇਸ ਕਰਕੇ ਮੇਰਾ ਮਨ ਵੀ ਹਲਕਾ ਹੋ ਜਾਂਦਾ ਸੀ ਅਤੇ ਮੈਂ ਪਰੇਸ਼ਾਨੀਆਂ ਤੋਂ ਵੀ ਬਚ ਜਾਂਦੀ ਸੀ ਹੁਣ ਇਸ ਦਾ ਮੇਰੀ ਜ਼ਿੰਦਗੀ ਉੱਤੇ ਕਾਫੀ ਸਕਾਰਾਤਮਕ ਅਸਰ ਹੋਇਆ ਹੈ